ਸਾਡੇ ਖੇਤਰ ਦੇ ਹਸਪਤਾਲਾਂ ਵਿੱਚ ਬਿਸਤਰੇ ਆਕਸੀ ਸਿਲਿੰਡਰ ਆ ਸਰਜੀਕਲ ਔਜਾਰ ਦੇ ਰੂਪ ਵਿੱਚ ਲੋੜੀਂਦੇ ਸਰੋਤ ਪੂਰੇ ਹਨ ਸਾਨੂੰ ਇਹ ਇਹਨਾਂ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਨਾ ਹੀ ਕੋਈ ਇਹੋ ਜਿਹਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਰਕਾਰ ਨੇ ਇਹ 'ਤੇ ਬਹੁਤ ਵਧੀਆ ਧਿਆਨ ਦਿੱਤਾ ਅਤੇ ਨਾ ਹੀ ਕੋਈ ਲੰਬੀਆਂ ਲਾਈਨਾਂ ਲੱਗਦੀਆਂ ਹਨ ਸਭ ਦਵਾਈਆਂ ਹਸਪਤਾਲ ਦੇ ਵਿੱਚੋਂ ਮਿਲਦੀਆਂ ਨੇ ਅਤੇ ਦੱਸ ਰੁਪਈਆਂ ਦੀ ਪਰਚੀ ਹੈ ਸਾਰੇ ਡਾਕਟਰ ਇੱਥੇ ਅਪਲੰਧਨ ਕੋਈ ਇਹੋ ਜਿਹੀ ਦਿੱਕਤ ਨਹੀਂ ਕਿ ਜੇ ਕੋਈ ਕਿਸੇ ਮਰੀਜ਼ ਨੂੰ ਕੋਈ ਦਵਾਈ ਨਾ ਮਿਲੇ ਜੇ ਕੋਈ ਨਹੀਂ ਵੀ ਹੈ ਤਾਂ ਉਹ ਬਾਹਰੋਂ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ